ਛੱਬੀ ਜਨਵਰੀ ਉੱਨੀ ਸੌ ਪੰਜਾਹ ਚੌਦ੍ਹਾਂ ਅਗਸਤ ਉੱਨੀ ਸੌ ਸੰਤਾਲੀ ਤੀਹ ਅਗਸਤ ਦੋ ਹਜ਼ਾਰ ਤਿੰਨ ਅਠਾਈ ਜੂਨ ਦੋ ਹਜ਼ਾਰ ਨੌ ਸਤਾਈ ਸਤੰਬਰ ਉੱਨੀ ਸੌ ਨੱਬੇ